ਸਾਡੇ ਰਾਜ ਵਿੱਚ ਬਹੁਤ ਸਾਰੇ ਪ੍ਰਮੁੱਖ ਤਿਉਹਾਰ ਮਨਾਏ ਜਾਂਦੇ ਨੇਗੇ ਜਿਵੇਂ ਦਿਵਾਲੀ ਈਦ ਕ੍ਰਿਸਮਿਸ ਵਿਸਾਖੀ ਹੋਲੀ ਸਾਡੇ ਹੋਲੀ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈਗੀ ਕਿਉਂਕਿ ਉਸ ਦਿਨ ਰਾਮ ਚੰਦਰ ਜੀ ਚੌਦ੍ਹਾਂ ਸਾਲ ਦਾ ਬਨਵਾਸ ਕੱਟ ਕੇ ਮਾਤਾ ਸੀਤਾ ਜੀ ਨੂੰ ਲੈ ਕੇ ਬਨ ਅਯੋਧਿਆ ਵਾਪਸ ਪਹੁੰਚੇ ਸੀਗੇ ਉਹਨਾਂ ਦੀ ਆਉਣ ਦੀ ਖੁਸ਼ੀ 'ਚ ਅਸੀਂ ਘਰਾਂ ਵਿੱਚ ਦੀਵੇ ਬਾਲਦੇ ਹੈਗੇ ਅਤੇ ਅਸੀਂ ਉਸ ਦਿਨ ਬਹੁਤ ਸਾਰੇ ਪਟਾਕੇ ਚਲਾਉਣੇ ਹੈਗੇ ਮਿਠਾਈਆਂ ਖਾਂਦੇ ਹਾਂ ਅਤੇ ਨਵੇਂ ਕੱਪੜੇ ਖ ਖਰੀਦੇ ਹੈਗੇ ਦਿਵਾਲੀ ਸਾਡਾ ਬਹੁਤ ਧੂਮ ਧਾਮ ਨਾਲ ਮਨਾਇਆ ਜਾਣ ਵਾਲਾ ਇੱਕ ਤਿਉਹਾਰ ਹੈਗਾ ਸਾਡੇ ਦੇਸ਼ ਵਿੱਚ ਹੋਲੀ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਹੋਲੀ ਸਾਡੇ ਇੱਕ ਰੰਗਾਂ ਦਾ ਤਿਉਹਾਰ ਹੈਗਾ ਉਸ ਦਿਨ ਅਸੀਂ ਉਸ ਦਿਨ ਅਸੀਂ ਸਾਰਿਆਂ ਨੂੰ ਰੰਗ ਲਗਾਉਣੇ ਹੈਗੇ ਅਤੇ ਇ ਉਸ ਦਿਨ ਅਸੀਂ ਸਾਰੇ ਇਕੱਠੇ ਮਿਲ ਕੇ ਮਿਠਾਈਆਂ ਖਾਂਦੇ ਹੈਗੇ ਅਤੇ ਹੋਲੀ ਮਨਾਉਂਦੇ ਹੈਗੇ ਇੱਕ ਦੂਜੇ ਨੂੰ ਰੰਗ ਲਗਾ ਕੇ ਧੰਨਵਾਦ